ਭਾਰਤੀ ਮੀਡੀਆ ਨੂੰ ਭਾਰਤ ਦੇ ਲੋਕਤੰਤਰ ਦਾ ਚੌਥਾ ਸਤੰਭ ਕਿਹਾ ਜਾਂਦਾ ਹੈ ਭਾਰਤੀ ਮੀਡੀਆ ਕਈ ਤਰੀਕੇ ਨਾਲ ਭਾਰਤ ਦੇ ਲੋਕਾਂ ਦੇ ਉੱਤੇ ਆਪਣਾ ਮਨ ਦੇ ਉੱਤੇ ਪ੍ਰਭਾਵ ਪਾਉਂਦਾ ਹੈ ਉਹ ਖ਼ਬਰਾਂ ਨੂੰ ਸਹੀ ਅਤੇ ਗਲਤ ਦੋਵੇਂ ਤਰੀਕਿਆਂ ਨਾਲ ਪੇਸ਼ ਕਰ ਸਕਦਾ ਹੈ ਮੀਡੀਆ ਦਾ ਰੋਲ ਜਿਹੜਾ ਹੈ ਉਹ ਜਿੰਨਾ ਨਿਰਪੱਖ ਹੋਵੇਗਾ ਉੰਨਾ ਹੀ ਵਧੀਆ ਅਤੇ ਸੁਹਾਵਾ ਹੋਵੇਗਾ ਮੈ ਭਾਰਤ ਦਾ ਮੀਡੀਆ ਬਹੁਤ ਹੀ ਸਹੀ ਤਰੀਕੇ ਨਾਲ ਅਤੇ ਸੁਚੱਜੇ ਢੰਗ ਨਾਲ ਖ਼ਬਰਾਂ ਪੇਸ਼ ਕਰਦਾ ਹੈ ਪਰ ਕਈ ਵਾਰ ਕੁਛ ਨਿਊਜ਼ ਚੈਨਲ ਕਿਸੇ ਕੁਛ ਪਕਸ਼ ਦੇ ਹੱਕ ਦੇ ਵਿੱਚ ਭੁਗਤਦੇ ਹੋਏ ਕੁਛ ਖ਼ਬਰਾਂ ਨੂੰ ਕੁਝ ਐਸੇ ਟੈ ਤਰੀਕੇ ਜਾਂ ਤੋੜ ਮਰੋੜ ਕੇ ਪੇਸ਼ ਕਰ ਦਿੰਦੇ ਹਨ ਜਿਸ ਨਾਲ ਉਹ ਖ਼ਬਰਾਂ ਦੇ ਚੱਲਣ ਨਾਲ ਕੋਈ ਧਾਰਮਿਕ ਜਾਂ ਕੋਈ ਹੋਰ ਤਰ੍ਹਾਂ ਦੇ ਸਮਾਜਿਕ ਦੇ ਵਿੱਚ ਸਮਾਜ ਦੇ ਵਿੱਚ ਕੋਈ ਭੜਕਾਹਟ ਪੈਦਾ ਹੋ ਸਕਦੀ ਹੈ ਕੁਝ ਅਖ਼ਬਾਰਾਂ ਹਨ ਦੈਨਿਕ ਭਾਸਕਰ ਅਜੀਤ ਜਿਹੜੀਆਂ ਅਖ਼ਬਾਰਾਂ ਕੋਈ ਅੱਛਾ ਲਿਖਣ ਦੇ ਯੋਗ ਹਨ ਕਈ ਅੱਛੀਆਂ ਖ਼ਬਰਾਂ ਲਿਖਦੀਆਂ ਹਨ ਅਤੇ ਉਹਨਾਂ ਅਖ਼ਬਾਰਾਂ ਦਾ ਸਰਕਾਰਾਂ ਦੇ ਉੱਤੇ ਬਹੁਤ ਢੁ ਢੁਕਵਾ ਅਸਰ ਵੀ ਹੁੰਦਾ ਹੈ ਲੋਕਾਂ ਦੇ ਉੱਤੇ ਵੀ ਉਹਨਾਂ ਦਾ ਅਸਰ ਹੈ ਅਤੇ ਉਹ ਲੋਕ ਜੋ ਹਨ ਉਹਨਾਂ ਅਖ਼ਬਾਰਾਂ ਦੀਆਂ ਖ਼ਬਰਾਂ ਨੂੰ ਬਹੁਤ ਚੰਗੀ ਤਰ੍ਹਾਂ ਅਤੇ ਬਹੁਤ ਹੀ ਨਿਰਪੱਖ ਸਮਝ ਕੇ ਉਹਨਾਂ 'ਤੇ ਯਕੀਨ ਵੀ ਕਰਦੇ ਹਨ ਅਖ਼ਬਾਰਾਂ ਹੋਰ ਵੀ ਕਈ ਸਹੂਲਤਾਂ ਪ੍ਰਦਾਨ ਕਰ ਸਕਦੀਆਂ ਹਨ ਜਿਵੇਂ ਕਿ ਲੋਕਾਂ ਦੇ ਵਿੱਚ ਧਾਰਮਿਕ ਅਤੇ ਸਮਾਜਿਕ ਭਾਵਨਾਵਾਂ ਪੈਦਾ ਕਰਨੀ ਅਤੇ ਭਾਈਚਾਰਿਕ ਸਾਂਝ ਪੈਦਾ ਕਰਨੀ ਇਹ ਅਖ਼ਬਾਰਾਂ ਦਾ ਅਤੇ ਮੀਡੀਆ ਦਾ ਇਹ ਇੱਕ ਬਹੁਤ ਹੀ ਸੁਚੱਜਾ ਅਤੇ ਸੁਭਾਵਿਕ ਰੋਲ ਹੈ ਧੰਨਵਾਦ